ਸਾਡੀਆਂ ਨਹਿਰਾਂ ਬਹੁਤ ਵਧੀਆ ਕੁਦਰਤੀ ਸਰੋਤ ਹਨ ਜੋ ਕਿ ਸਾਡੇ ਖੇਤੀਬਾੜੀ ਗਤੀਵਿਧੀਆਂ ਨੂੰ ਬਹੁਤ ਵਧਾ ਸਕਦੇ ਹਨ ਇਸ ਕਰਕੇ ਸਾਡੇ ਖੇਤਰ ਵਿੱਚ ਪੱਕੀਆਂ ਨਹਿਰਾਂ ਸਾਡੇ ਪਾਣੀ ਬਹੁਤ ਹੀ ਜ਼ਿਆਦਾ ਵਧੀਆ ਕੁਦਰਤੀ ਸਰੋਤ ਹੈ